ਹਾਂਜੀ ਜੀ ਭਾਅ ਜੀ ਜੈਐਮ ਸੀ ਦੀ ਜੀ ਵਧੀਆ ਜੀ ਵਧੀਆ ਮੈਂ ਨਾ ਸਰ ਤੁਹਾਡਾ ਨੰਬਰ ਮਿਲਿਆ ਸੀ ਜੀ ਐਮ ਸੀ ਬੋਲਦੇ ਤੁਸੀਂ ਬੰਦਾ ਬਹਾਦਰ ਕਲੋਨੀ ਤੋਂ ਉਹ ਸਰ ਆਪਾਂ ਨਾ ਸ਼ਿਫਟ ਹੋਏ ਹਾਂ ਸਰ ਉੱਥੇ ਤੁਹਾਡੀ ਕਲੋਨੀ 'ਚ ਗੱਲ ਇੱਦਾਂ ਹੋਈ ਹੈ ਕਿ ਸਭ ਤੋਂ ਪਹਿਲੇ ਕਿ ਦੁੱਧ ਜਿਹੜਾ ਬੱਚੇ ਦਾ ਸਭ ਤੋਂ ਵਧੀਆ ਆਹਾਰ ਹੁੰਦਾ ਅਤੇ ਆਪਾਂ ਇਹ ਹੀ ਚਾਹੁੰਦੇ ਹਾਂ ਕਿ ਜੇ ਇਕ ਆਪਾਂ ਜੀ ਸਰ ਆਏ ਹਾਂ ਜੀ ਸੰਗਰੂਰ ਤੋਂ ਇਲਾਕਾ ਤੁਹਾਡਾ ਵੇਖਿਆ ਚਲੋ ਸਾਨੂੰ ਡਿਊਟੀ ਇੱਥੇ ਹੀ ਆਪਾਂ ਜਗ੍ਹਾ ਲੈ ਲਈ ਇੱਥੇ ਮੇਰੀ ਟ੍ਰਾਂਸਫਰ ਆ ਮੈਂ ਇੱਥੇ ਰਹਿੰਦਾ ਮੇਰੀ ਹੁਣ ਫੈਮਲੀ ਹੈ ਜੀ ਬੇਟਾ ਨਾਲ ਅਤੇ ਮੇਰੀ ਬੇਟੀ ਨਾਲ ਮੇਰੀ ਵਾਈਫ ਹੈ ਨਾਲ ਮੇਰੇ ਮਾਤਾ ਪਿਤਾ ਗੱਲ ਇਹ ਆ ਕਿ ਆਪਾਂ ਦੁੱਧ ਨਾ ਗੱਲ ਸਰ ਮੈਂ ਤੁਹਾਨੂੰ ਦੱਸਦਾ ਮੇਨ ਗੱਲ ਕੀ ਆ ਦੁੱਧ ਲੈਂਦਾ ਜੀ ਪਿੰਡੋਂ ਡੇਅਰੀ ਦਾ ਡੇਅਰੀ ਦਾ ਨਹੀਂ ਸਰ ਜਿਹੜੇ ਪਿੰਡ ਦੇ ਲੋਕ ਆਉਂਦੇ ਆ ਸਾਡੀ ਕਲੋਨੀ 'ਚ ਤੁਸੀਂ ਐਮ ਸੀ ਹੋ ਉਹ ਦੁੱਧ 'ਚ ਸਰ ਲੈ ਕੇ ਰੱਖਿਆ ਸਵੇਰੇ ਅਤੇ ਖ਼ਰਾਬ ਹੋ ਗਿਆ ਦੋ ਘੰਟੇ 'ਚ ਹੀ ਹੁਣ ਤੁਸੀਂ ਮੈਨੂੰ ਸਰ ਐਂ ਦੱਸੋ ਕਿ ਦੁੱਧ ਬਾਰੇ ਕਿ ਸਭ ਤੋਂ ਬੈਸਟ ਡੇਅਰੀ ਗੁਰਦਾਸਪੁਰ 'ਚ ਕਿਹੜੀ ਹੈ ਤੁਸੀਂ ਵੀ ਕਰਦੇ ਹੋ ਤੁਸੀਂ ਬਹੁਤ ਪੁਰਾਣੇ ਹੋ ਜਿਹੜਾ ਸਾਨੂੰ ਵਧੀਆ ਤਰੀਕੇ ਨਾਲ ਸਾਡਾ ਬੱਚਿਆਂ ਦਾ ਵਿੱਚ ਜਿਹੜਾ ਪਾਲਣ ਪੋਸ਼ਣ ਹੋਏ ਅੱਛਾ ਜੀ ਬਸੰਤ ਦੀ ਡੇਅਰੀ ਹਾਂਜੀ ਹਾਂਜੀ ਮੈਂ ਉਹ ਕਹਿੰਦਾ ਕਿ ਚਲੋ ਦੁੱਧ ਵਧੀਆ ਮਿਲੇ ਪਰ ਘਰ ਦਾ ਹੋ ਜੂ ਉਹਦੇ ਵਿੱਚੋਂ ਸਾਨੂੰ ਪੈ ਪੈਸੇ ਵੱਧ ਲੱਗ ਜਾਣ ਬਟ ਐਂ ਕਿ ਉਹ 'ਚੋਂ ਘਿਓ ਨਿਕਲ ਜਾਵੇ ਮੱਖਣ ਨਿਕਲ ਜਾਵੇ ਆਪਾਂ ਉਹਦੇ ਵਿੱਚ ਮੇਰੀ ਵਾਈਫ ਕਰ ਦਿੰਦੀ ਆ ਉਹ ਬਿਲਕੁਲ ਬਿਲਕੁਲ ਆ ਅਤੇ ਉਹੀ ਗੱਲ ਆ ਗਈ ਨਾ ਸਰ ਤੁਸੀਂ ਵਧੀਆ ਬੋਲਿਆ ਪਿੰਡੋਂ ਨਾ ਬਾਏ ਦੋ ਦਿਨ ਮੰਗਵਾਇਆ ਅਤੇ ਉਹ ਪਰ ਦੋਵੇਂ ਦਿਨ ਦੁੱਧ ਖ਼ਰਾਬ ਹੋਇਆ ਹੁਣ ਆਪਾਂ ਕਿਹਾ ਨਹੀਂ ਅਪਾਂ ਅੱਜ ਹਟਾ ਤਾਂ ਮੈਂ ਕਿਹਾ ਚਲੋ ਸਾਡੀ ਬਾਕਵੀ ਨਹੀਂ ਆਪਾਂ ਨੰਬਰ ਐਮ ਸੀ ਤੁਹਾਡਾ ਲੱਗ ਰਿਹਾ ਸੀ ਕੰਧ 'ਤੇ ਬੋਰਡ 'ਤੇ ਨੰਬਰ ਉਹ ਕਰਕੇ ਅਤੇ ਮੈਂ ਨੰਬਰ ਲੈ ਕੇ ਠੀਕ ਹੈ ਜੀ ਸਰ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਮੈਂ ਮੈਨੂੰ ਸੁਣਨ 'ਚ ਆਇਆ ਵੀ ਆਪਣਾ ਤੁਸੀਂ ਨਾਮ ਲਿਆ ਸ਼ੈਲੀ ਡੇਅਰੀ ਇਹਨਾਂ ਦਾ ਰੇਟ ਥੋੜ੍ਹਾ ਜ਼ਿਆਦਾ ਨਹੀਂ ਆ ਓਕੇ ਓਕੇ ਹੋਰ ਕਿਹੜੀ ਆ ਦੱਸੋ ਜੇ ਹੋਰ ਇਹ ਤੋਂ ਇਲਾਵਾ ਜੇ ਨੇੜੇ ਪੈ ਜਾਵੇ ਆਪਣੇ ਕਲੋਨੀ ਦੇ ਨਾਲ ਹੈ ਕੋਈ ਉਹ ਮੈਂ ਇੱਕ ਸੁਣੀ ਹਜੇ ਚਾਹੀਏ ਮੈਂ ਲਾਗੇ ਵੀ ਜਿਹੜਾ ਪਿੰਡ ਪੈਂਦਾ ਉੱਥੇ ਹੈਗੀ ਆ ਚਲੋ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਡਿਊਟੀ ਨਿਭਾਈ ਮੈਨੂੰ ਖੁਸ਼ੀ ਹੈ ਕਿ ਸਾਡੇ ਐਮ ਸੀ ਇੱਦਾਂ ਦੇ ਸਾਨੂੰ ਮਿਲੇ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਠੀਕ ਹੈ ਧੰਨਵਾਦ ਜੀ